ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਇਹਨਾਂ ਖੇਡਾਂ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਖੇਡਾਂ ਹਨ ਜਿਹੜੀਆਂ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਮਾਨਤਾ ਲੈ ਚੁੱਕੀਆਂ ਨੇ ਅਤੇ ਵਧੇਰੇ ਖੇਡਾਂ ਇਹੇ ਜਿਹੀਆਂ ਹਨ ਜਿਹਨਾਂ ਨੂੰ ਮਾਨਤਾ ਦੀ ਲੋੜ ਹੈ ਉਹਨਾਂ ਖੇਡਾਂ ਦੇ ਵਿੱਚ ਕਬੱਡੀ ਖੋ ਖੋ ਗੁੱਲੀ ਡੰਡਾ ਅਤੇ ਇਸੇ ਤਰ੍ਹਾਂ ਇੱਕ ਸਾਡੀ ਬਾਂਦਰ ਕਿੱਲਾ ਖੇਡ ਹੈ ਜਿਹੜੀ ਨੂੰ ਮਤਲਬ ਪ ਪੰਜਾਬ ਦੇ ਵਿੱਚ ਤਾਂ ਪੂਰੇ ਭਾਰਤ ਦੇ ਵਿੱਚ ਬਹੁਤ ਚ ਵੱਡੇ ਪੱਧਰ 'ਤੇ ਖੇਡਿਆ ਜਾਂਦਾ ਪਰ ਉਹਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਮਿਲੀ ਅੰਤਰਰਾਸ਼ਟਰੀ ਮਾਨਤਾ ਦੇਣ ਵਾਸਤੇ ਬਾਂਦਰ ਕਿੱਲਾ ਖਾਸ ਕਰ ਅਤੇ ਗੁੱਲੀ ਡੰਡੇ ਨੂੰ ਅਸੀਂ ਮਤਲਬ ਨਵੇਂ ਨਵੇਂ ਤਰੀਕੇ ਨਾਲ ਕੰਪਿਊਟਰ ਦੇ ਉੱਤੇ ਵੀ ਅਸੀਂ ਇਹਨੂੰ ਲੈ ਕੇ ਜਾ ਰਹੇ ਆ ਹੁਣ ਪਰ ਇਹਨੂੰ ਇਹ ਇਹਨੂੰ ਸੋਸ਼ਲ ਮੀਡੀਆ 'ਤੇ ਖਾਸ ਕਰਕੇ ਜਿਵੇਂ ਟਵਿਟਰ ਹੋਇਆ ਯੂਟਿਊਬ ਹੋਇਆ ਜਾਂ ਟੀਵੀ ਚੈਨਲ ਨੇ ਅੱਜ ਕੱਲ੍ਹ ਜੇ ਇਹ ਇਹਨਾਂ ਨੂੰ ਮਾੜਾ ਮੋਟਾ ਦਿਖਾਉਣਗੇ ਜਿਸ ਤਰ੍ਹਾਂ ਕ੍ਰਿਕਟ ਨੂੰ ਸਾਰਾ ਦਿਨ ਦਿਖਾਈ ਜਾਂਦੇ ਨੇ ਅਤੇ ਇਸ ਗੇਮ ਇਹਨਾਂ ਗੇਮਾਂ ਨੂੰ ਦਿਖਾਉਣ ਤਾਂ ਸਾਡੀ ਜਿਹੜੀ ਇੱਕ ਗੇਮ ਹੈ ਗੁੱਲੀ ਡੰਡਾ ਖੋ ਖੋ ਕਬੱਡੀ ਬਾਂਦਰ ਕਿੱਲਾ ਤਾਂ ਇਹਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲ ਸਕਦੀ ਹੈ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਲੈਣ ਵਾਸਤੇ ਪਹਿਲਾਂ ਉਹਨਾਂ ਪੂਰੀ ਦੁਨੀਆਂ ਨੂੰ ਇਹ ਗੇਮ ਬਾਰੇ ਜਾਣਕਾਰੀ ਹੋਵੇਗੀ ਤਾਂ ਹੀ ਉਹ ਖੇਡਣਗੇ ਇਸ ਗੇਮ ਨੂੰ ਇਸ ਕਰਕੇ ਮ ਇਸ ਇਸ ਗੇਮ ਨੂੰ ਪਹਿਲਾਂ ਪੂਰੀ ਦੁਨੀਆਂ ਦੇ ਵਿੱਚ ਇਸ ਗੇਮ ਦੀ ਲੋਕਾਂ ਨੂੰ ਦੱਸਣਾ ਪਊ ਮ ਮਹੱਤਤਾ ਦੱਸਣੀ ਪਵੇਗੀ ਵੀ ਇਹਦੇ ਨਾਲ ਸਰੀਰ ਦਾ ਕਿਹੜਾ ਕਿਹੜਾ ਸਰੀਰ ਦਾ ਤੁਹਾਡੇ ਦਾ ਹਿੱਸਾ ਜਿਹੜਾ ਜਿਹੜਾ ਇਹਦੇ ਨਾਲ ਜਿਹਨੂੰ ਫਾਇਦੇ ਹੋਣਗੇ ਜਿਸ ਤਰ੍ਹਾਂ ਕ੍ਰਿਕਟ ਹੈ ਕ੍ਰਿਕਟ ਨਾਲ ਕਿਸੇ ਗੱਲ ਨੂੰ ਕਿਸੇ ਨੂੰ ਕੋਈ ਫਾਇਦੇ ਨਹੀਂ ਫਾਇਦੇ ਨਹੀਂ ਹੁੰਦਾ ਕ੍ਰਿਕਟ ਨੇ ਕਿਸੇ ਨੂੰ ਕੀ ਫਾਇਦਾ ਦੇਣਾ ਪਰੰਤੂ ਜਿਹੜੀ ਇੱਕ ਗੇਮ ਹੈ ਜਿਹੜੀ ਸਾਡੀ ਖੋ ਖੋ ਹੈ ਖੋ ਖੋ ਗੇਮ ਸਾਡੇ ਪੂਰੇ ਸਰੀਰ ਨੂੰ ਮਤਲਬ ਇਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਵਰਜਿਸ਼ ਕਰਵਾਉਂਦੀ ਹੈ ਕਿ ਸਾਡਾ ਸਰੀਰ ਚੰਗੀ ਤਰ੍ਹਾਂ ਐਨ ਪੂਰੀ ਤਰੀਕੇ ਦੇ ਨਾਲ ਰਿਸ਼ਟ ਪੁਸ਼ਟ ਰਹਿੰਦਾ ਜੇਕਰ ਅਸੀਂ ਖੋ ਖੋ ਖੇਡਦੇ ਹਾਂ ਇਸੇ ਤਰ੍ਹਾਂ ਕਬੱਡੀ ਕਬੱਡੀ ਇੱਕ ਪਾਵਰ ਗੇਮ ਹੈ ਜੇ ਉਹਨੂੰ ਖੇਡਿਆ ਜਾਵੇ ਤਾਂ ਸਰੀਰ ਦੇ ਵਿੱਚ ਪੂਰੇ ਪੂਰੇ ਜ ਜੋਰ ਆਉਂਦਾ ਜੋਰ ਅਜ਼ਮਾਇਸ਼ ਕਰਨ ਨਾਲ ਸਾਡਾ ਸਰੀਰ ਜਿਹੜਾ ਹੈਗਾ ਪੂਰੀ ਤਰ੍ਹਾ ਵੱਧਦਾ ਫੁਲਦਾ ਇਸੇ ਤਰਾਂ ਬਾਂਦਰ ਕਿੱਲਾ ਬਾਂਦਰ ਕਿੱਲੇ ਨਾਲ ਸਾਡੇ ਚੁਸਤੀ ਆਉਂਦੀ ਹੈ ਅਤੇ ਇਸੇ ਤਰ੍ਹਾਂ ਸਾਡੇ ਇੱਕ ਗੇਮਸ ਜਿਹੜੀ ਹੈਗੀ ਆ ਉਹ ਆਮ ਕਰਕੇ ਖੇਡੀ ਜਾਂਦੀ ਹੈ ਜਿਵੇਂ ਬ ਬਾਂਦਰ ਕਿੱਲੇ ਦੇ ਨਾਲ ਇੱਕ ਜਿਹੜਾ ਹੈਗਾ ਉਹ ਆਪਣਾ ਖੋ ਖੋ ਖੋ ਖੋ ਨੂੰ ਵੀ ਮਤਲਬ ਪੂਰੀ ਦੁਨੀਆਂ ਵਿੱਚ ਖੇਡਿਆ ਜਾਂਦਾ ਪਰ ਮਾਨਤਾ ਹਲੇ ਮਿਲੀ ਨਹੀਂ ਅੰਤਰਰਾਸ਼ਟਰੀ ਪੱਧਰ 'ਤੇ ਧੰਨਵਾਦ